ਹੈਲੋ ਹਾਂਜੀ ਭਾਅ ਜੀ ਮੈਂ ਕਿਹਾ ਭਾਅ ਜੀ ਫਲਿੱਪ ਕਾਟ ਤੋਂ ਗੱਲ ਕਰਦੇ ਐ ਭਾਅ ਜੀ ਮੈਂ ਕਿਹਾ ਭਾਅ ਜੀ ਦੋ ਤਿੰਨ ਦਿਨ ਹੋਏ ਮੈਂ ਤੁਹਾਡੇ ਤੋਂ ਏਸੀ ਬੁੱਕ ਕਰਾਇਆ ਸੀਗਾ ਭਾਅ ਜੀ ਮੈਂ ਕਿਹਾ ਭਾਅ ਜੀ ਵੋਲਟਸ ਦਾ ਏਸੀ ਸੀ ਭਾਜੀ ਬਹੁਤ ਵਧੀਆ ਨਿਕਲਿਆ ਏਸੀ ਭਾਅ ਜੀ ਓਨੇ ਡਿਲਵਰੀ ਏਨੀ ਵਧੀਆ ਹੀ ਨਾ ਭਾਅ ਜੀ ਉਹਦਾ ਪੈਕਿੰਗ ਐਨਾ ਵਧੀਆ ਕੀਤੀ ਹੀ ਨਾ ਪੀ ਕੋਈ ਤੋੜ ਭੱਜ ਹੋਵੇ ਤੇ ਨਾ ਕੋਈ ਕਸਟਮਰ ਦਾ ਨੁਕਸਾਨ ਹੋਵੇ ਤੇ ਨਾ ਹੀ ਉਹਨਾਂ ਨੂੰ ਨੁਕਸਾਨ ਹੋਵੇ ਮੈਂ ਕਿਹਾ ਭਾਅ ਜੀ ਇੰਨਾ ਵਧੀਆ ਏਸੀ ਭਾਅ ਜੀ ਦੋ ਤਿੰਨ ਦਿਨ ਹੋਏ ਆ ਭਾਅ ਜੀ ਏਸੀ ਐਨੀ ਕੂਲਿੰਗ ਵਧੀਆ ਕਰਦਾ ਪਿਆ ਭਾਅ ਜੀ ਭਾਅ ਜੀ ਮੈਨੂੰ ਜਿਹੜਾ ਵੀ ਪੁੱਛਦਾ ਵਾ ਭਾਅ ਜੀ ਤਾਡੀ ਤਾਡਾ ਈ ਮੈਨੂੰ ਸ਼ੋਪ ਸ਼ੋਪ ਤਾਡਾ ਈ ਫਲਿੱਪ ਕਾਟ ਚ ਨ ਨਾਮ ਦਿੰਨਾ ਵਈ ਵੋਲਟਾਸ ਦਾ ਏਸੀ ਮੰਗਾਓ ਵਧੀਆ ਵਾ ਨਾਲੇ ਇਹਦੀ ਬਿਜਲੀ ਘੱਟ ਖਿੱਚਦਾ ਵਾ ਭਾਅ ਜੀ ਤੇ ਨਾਲੇ ਕੁਲਰਸ ਫੈਨਸ ਨਾਲੋ ਜਿਆਦਾ ਵਧੀਆ ਵਾ ਇਹ ਭਾਅ ਜੀ ਵੋਲਟਸ ਦਾ ਏਸੀ ਲਓ ਭਾਅ ਜੀ ਮੈਂ ਤਾ ਥੋਨੂੰ ਸਾਰਿਆਂ ਨੂੰ ਇਹੀ ਕਹਿੰਨਾ ਭਾਅ ਜੀ ਉਹਨਾਂ ਨੂੰ ਵੀ ਜਿਹੜੇ ਮੈਨੂੰ ਪੁਛਦੇ ਐ ਵਈ ਵੋਲਟਸ ਦਾ ਏਸੀ ਲਓ ਭਾਅ ਜੀ ਮੈਂ ਤਾਡੇ ਤਾਡੀ ਸਾਈਟ ਦੱਸਦਾਂ ਫਲਿੱਪ ਕਾਟ ਤੋਂ ਕਿਉਂਕੀ ਭਾਜੀ ਉਹਨਾਂ ਨੇ ਮੈਨੂੰ ਇੱਕ ਮੇਰਾ ਕਸ ਮੇਰਾ ਫਰੈਂਡ ਐ ਉਹਨੇ ਮੈਨੂੰ ਪੁਛਿਆ ਜੀ ਕਹਿੰਦਾ ਕਿੱਥੋਂ ਮੰਗਾਮਾਂ ਏਸੀ ਮੈਂ ਕਿਹਾ ਭਾਅ ਜੀ ਤੋਡੇ ਤੋਂ ਮੰਗਾਓ ਸ਼ੈਦ ਉਹਨੇ ਮੰਗਾਇਆ ਹੋਣਾ ਭਾਅ ਜੀ ਤਾਡੇ ਤੋਂ